ਹੈਲੋ ਵੀਰ ਜੀ ਮੈਂ ਕਾਰ ਬੁੱਕ ਕਰਨੀ ਆ ਅਤੇ ਤ ਕੀ ਤੁਸੀਂ ਜਲਦੀ ਆ ਰਹੇ ਹੋ ਮੈਂ ਘਰ ਤੋਂ ਸਟੇਸ਼ਨ ਪਹੁੰਚਣਾ ਆ ਅਤੇ ਮੈਨੂੰ ਥੋੜ੍ਹੀ ਜਲਦੀ ਆ ਅਤੇ ਮੇਰਾ ਉੱਥੇ ਬਹੁਤ ਘੱਟ ਟਾਇਮ ਆ ਮੇਰੇ ਕੋਲ ਉੱਥੇ ਪਹੁੰਚਣ ਲਈ ਅਤੇ ਕੀ ਤੁਸੀਂ ਪਹਿਲਾਂ ਆ ਸਕਦੇ ਓਂ